ਹੈਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਦੱਸੋ ਕਿਹੜੇ ਲੈਣੇ ਜੀ ਹਾਂਜੀ ਸਾਰੇ ਹੈਗੇ ਨੇ ਜੀ ਤੁਸੀਂ ਦੱਸੋ ਮਤਲਬ ਹਾਂਜੀ ਵੀ ਕਿੰਨੀ ਆਲਾ ਸੈੱਟ ਲੈਣਾ ਏ ਹਾਂਜੀ ਛੇ ਛੋਟੀਆਂ ਪਲੇਟਾਂ ਛੇ ਵੱਡੀਆਂ ਹਾਂਜੀ ਤਿੰਨ ਬਾਲ ਹੁੰਦੇ ਨੇ ਹਾਂਜੀ ਕਲਰ ਤਾਂ ਵਾਈਟ ਈ ਹੁੰਦੇ ਨੇ ਡਿਜ਼ਾਇਨ ਅਲੱਗ ਅਲੱਗ ਹੋ ਜਾਂਦੇ ਨੇ ਵਿਚ ਇਕ ਬਲੈਕ ਕਲਰ ਵੀ ਅੱਜ ਹਾਂਜੀ ਬਲੈਕ ਪਲੇਨ ਵੀ ਜਿਵੇਂ ਅੱਜ ਕੱਲ ਚੱਲਦਾ ਪਿਆ ਏ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਐਵੇਂ ਜਿਵੇਂ ਆਪਾਂ ਕਈ ਵਾਰ ਰਾਤੀ ਰੱਖ ਦਿਨੇ ਆ ਵੀ ਚਲੋ ਸੁਬਹਾ ਸਾਫ ਕਰ ਲਾਂਗੇ ਕੋਈ ਐਵੇਂ ਦਾਗ ਦੂਗ ਨੀ ਸਬਜੀ ਦਾ ਲੱਗੇਗਾ ਹਾਂਜੀ ਹਾਂਜੀ ਨਹੀਂ ਨਹੀਂ ਉਹ ਕੋਈ ਨਹੀਂ ਤੁਸੀਂ ਮਤਲਬ ਜਿਵੇਂ ਦੋ ਕ ਹਜਾਰ ਤੋਂ ਤੋਂ ਸਟਾਰਟਿੰਗ ਹੋ ਜਾਂਦੀ ਹ ਬਾਕੀ ਕੋਈ ਨਹੀਂ ਕੋਈ ਡਿਸਕਾਊਂਟ ਵਗੈਰਾ ਵੀ ਹੋਏਗਾ ਆਪਾਂ ਜਰੂਰ ਕਰਾਂਗੇ ਹਾਂਜੀ ਹਾਂਜੀ ਜਿਵੇਂ ਛੇ ਛੇ ਹੁੰਦੇ ਨੇ ਚਲੋ ਉਹ ਇੱਕੋ ਜਿਹੇ ਮਿਲ ਜਾਣ ਤੇ ਫਿਰ ਬਾਰਾਂ ਹੋ ਜਾਣਗੇ ਵੈਸੇ ਛੇ ਦਾ ਹੀ ਹੁੰਦਾ ਸੈਟ ਹਾਂਜੀ ਹਾਂਜੀ ਛੇ ਸੋ ਤੋਂ ਸਟਾਰਟਿੰਗ ਹੋ ਜਾਂਦੇ ਵਧੀਆ ਹਾਂਜੀ ਬਾਰਾਂ ਬਾਰਾਂ ਹਾਂਜੀ ਹਾਂਜੀ ਜਿਵੇਂ ਹੁਣ ਨਿਊ ਈਅਰ ਤੇ ਜਾਂ ਲੋੜੀ ਤੇ ਕੁਛ ਡਿਸਕਾਊਂਟ ਵੀ ਹੋਏਗਾ ਪਹੁੰਚਿਆ ਜੇ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਹਾਂਜੀ ਹਾਂਜੀ ਸੰਡੇ ਬਸ ਦੋ ਵਜੇ ਤੱਕ ਹੁੰਦੀ ਹੈ ਹਾਂਜੀ ਹਾਂਜੀ ਜਰੂਰ ਪਹੁੰਚੋ ਜੀ ਹਾਂਜੀ ਓਕੇ ਜੀ